ਹਾਂ ਮੈਂ ਪੰਜਾਬ ਦੇ ਮਤਲਬ ਕਾਫ਼ੀ ਇਲਾਕਿਆਂ ਵਿਚ ਗਿਆ ਹੈ ਨਾ ਜਿੱਥੇ ਹਰੇਕ ਤਰ੍ਹਾਂ ਦੀ ਮਤਲਬ ਅਲੱਗ ਅਲੱਗ ਬੋਲੀ ਬੋਲੀ ਜਾਂਦੀ ਹੈ ਨਾ ਕਿਉਂਕਿ ਮਤਲਬ ਪਹਿਲੀ ਗੱਲ ਤਾਂ ਮਤਲਬ ਪੰਜਾਬ 'ਚ ਇੱਕੋ ਸ਼ਹਿਰ 'ਚ ਰਹਿ ਕੇ ਜੇ ਇਕ ਪਿੰਡ 'ਚ ਰਹਿ ਕੇ ਵੀ ਉਹਨਾਂ ਦੀ ਜੇ ਤੁਸੀਂ ਹਰੇਕ ਦੀ ਬੋਲੀ ਸੁਣੋਗੇ ਉਹ ਹਰੇਕ ਤੁਹਾਨੂੰ ਅਲੱਗ ਅਲੱਗ ਡਿਫਰੈਂਸ ਮਤਲਬ ਦਿਖੂਗਾ ਉਹਨਾ ਦੇ ਵਿੱਚ ਡਿਫਰੈਂਸ ਹੈਗਾ ਕੀ ਡਿਫਰੈਂਸ ਕੀ ਡਿਫਰੈਂਸ ਨਹੀਂ ਹੈਗਾ ਠੀਕ ਹੈ ਅਤੇ ਬਾਕੀ ਪੰਜਾਬ ਵਿੱਚ ਕਾਫ਼ੀ ਤਰ੍ਹਾਂ ਦੇ ਮਤਲਬ ਲੋਕ ਪਾਏ ਜਾਂਦੇ ਹੈ ਹੈ ਨਾ ਜਿਹਨਾਂ ਵਿੱਚ ਮਤਲਬ ਉਹ ਅਲੱਗ ਅਲੱਗ ਕੋਈ ਹਿੰਦੀ ਲੈਂਗੁਏਜ ਕੋਈ ਬਾਹਰ ਦੀ ਲੈਗੁਏਜ ਕੋਈ ਮਤਲਬ ਅਲੱਗ ਅਲੱਗ ਤਰਾਂ ਦੀ ਲੈਂਗੁਏਜ ਬੋਲਦਾ ਹੈ ਪਰ ਪੰਜਾਬੀ ਵਿੱਚ ਵੀ ਕਾਫ਼ੀ ਲੈਂਗੁਏਜ ਬੋਲੀਆਂ ਜਾਂਦੀਆਂ ਹੈ ਨਾ ਜਿਹਦੇ ਵਿੱਚ ਮਤਲਬ ਹਰੇਕ ਤਰ੍ਹਾਂ ਦੇ ਲਗਾ ਮਾਤਰਾ ਮਾਝਾ ਮਾਲਵਾ ਦੁਆਬਾ ਜੇ ਮਤਲਬ ਅਲੱਗ ਅਲੱਗ ਸ਼ਹਿਰਾਂ 'ਚ ਅਲੱਗ ਅਲੱਗ ਪਿੰਡਾਂ 'ਚ ਅਲੱਗ ਅਲੱਗ ਤਰ੍ਹਾਂ ਦੀਆਂ ਬੋਲੀਆਂ ਬੋਲੀਆਂ ਜਾਂਦੀਆਂ ਹਨ ਜਿਹਦੇ ਵਿੱਚ ਕੀ ਹੈ ਬੰਦਾ ਮਤਲਬ ਹਰੇਕ ਤਰ੍ਹਾਂ ਦੀ ਭਾਸ਼ਾ ਨੂੰ ਸਿੱਖਦਾ ਹੈ ਜੋ ਕਿੱਦਾਂ ਉਹਨੇ ਕੀ ਕਰਨਾ ਹਾਂ ਕਿੱਦਾਂ ਉਹਨੇ ਕੀ ਕਰਨਾ ਹੈ ਹੈ ਨਾ ਅਤੇ ਦੂਸਰੀ ਗੱਲ ਕੀ ਹੈ ਮਤਲਬ ਪੰਜਾਬ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਦੀ ਲੈਂਗੁਏਜ ਦੀ ਅਲੱਗ ਅਲੱਗ ਹੁੰਦੀ ਹੈ ਮਤਲਬ ਹਰ ਕੋਈ ਜਾਣਦਾ ਹੀ ਇਹਦੇ 'ਚ ਕੋਈ ਉਹ ਨਹੀਂ ਹੈਗਾ ਸੋਚਣ ਜਾਂ ਸਮਝਣ ਵਾਲੀ ਗੱਲ ਨਹੀਂ ਹੈਗੀ ਹੈ ਨਾ ਇਹ ਦੇ ਵਿੱਚ ਬਾਕੀ ਜਿੱਦਾਂ ਜਿੱਦਾਂ ਪੰਜਾਬ 'ਚ ਹੈਗਾ ਉੱਦਾਂ ਉੱਦਾਂ ਦਾ ਅਲੱਗ ਅਲੱਗ ਪੰਜਾਬ 'ਚ ਜਿਹੜੀਆਂ ਬੋਲੀਆਂ ਉਹ ਬੋਲੀਆਂ ਜਾਂਦੀਆਂ ਹੈਗੀਆਂ